ਹਾਂਜੀ ਪੇਂਡੂ ਖੇਤਰ ਵਿੱਚ ਨੌਜਵਾਨ ਪੀੜ੍ਹੀ ਨੂੰ ਜੀਵਨਸਾਥੀ ਪ੍ਰਾਪਤ ਕਰਨ ਲਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਅੱਜ ਕੱਲ੍ਹ ਦੀ ਜਿੰਨੀ ਵੀ ਜਨਰੇਸ਼ਨ ਹੈ ਉਹ ਪੜ੍ਹੀ ਲਿਖੀ ਹੈ ਅਤੇ ਹਰ ਕੋਈ ਨਵੇਂ ਤਰੀਕੇ ਮੌਡਰਨ ਤਰੀਕੇ ਨਾਲ ਰਹਿਣਾ ਹੀ ਪਸੰਦ ਕਰਦਾ ਹੈ ਜਿਸ ਕਰਕੇ ਹਰ ਕੋਈ ਸ਼ਹਿਰ ਵੱਲ ਹੀ ਜਾਣਾ ਚਾਹੁੰਦਾ ਹੈ ਪਿੰਡ ਵਿੱਚ ਰਹਿ ਕੇ ਕਈ ਚੀਜ਼ਾਂ ਨੇ ਜਿਨ੍ਹਾਂ ਨੂੰ ਉਹ ਆਪਣੇ ਸੁਪਨਿਆਂ ਨੂੰ ਪੂਰਾ ਨਹੀਂ ਕਰ ਸਕਦਾ ਪਿੰਡ ਵਿੱਚ ਕਈ ਚੀਜ਼ਾਂ ਦੀ ਰੋਕ ਟੋਕ ਹੁੰਦੀ ਹੈ ਜਿਸ ਵਿੱਚ ਕੋਈ ਵੀ ਬੱਚਾ ਜਾਂ ਨਵੀਂ ਪੀੜ੍ਹੀ ਅੱਜ ਕੱਲ੍ਹ ਰਹਿਣਾ ਜਮ੍ਹਾਂ ਨਹੀਂ ਪਸੰਦ ਕਰਦੀ ਹੈ ਆਪਣੀ ਫ਼ਰੀ ਮਰਜੀ ਨਾਲ ਕਿਤੇ ਵੀ ਘੁੰਮਣਾ ਆਉਣਾ ਜਾਣਾ ਕੁਛ ਵੀ ਕਰਨਾ ਇਹ ਸਭ ਲਈ ਹਰ ਕੋਈ ਸ਼ਹਿਰ ਵੱਲ ਵੱਧਦਾ ਜਾ ਰਿਹਾ ਹੈ ਅਤੇ ਹਰ ਅੱਜ ਕੱਲ੍ਹ ਦੀ ਪੜ੍ਹੀ ਲਿਖੀ ਕੁੜੀ ਪਿੰਡ ਪਿੰਡ ਨਾਲੋਂ ਸ਼ਹਿਰ ਨੂੰ ਪਰੈਫ਼ਰ ਕਰਦੀ ਹੈ ਅਤੇ ਆਪਣੇ ਤਰੀਕੇ ਨਾਲ ਹੀ ਰਹਿਣਾ ਚਾਹੁੰਦੀ ਹੈ ਜਿਸ ਕਰਕੇ ਨੌਜਵਾਨ ਪੀੜ੍ਹੀ ਨੂੰ ਕੋਈ ਵੀ ਆਪਣੀ ਅੱਗੇ ਜੀਵਨਸਾਥੀ ਚੁਣਨ ਲਈ ਪਿੰਡ ਵੱਲ ਨਹੀਂ ਜਦਕਿ ਸ਼ਹਿਰ ਵੱਲ ਜਾਣਾ ਪੈਂਦਾ ਹੈ ਅਤੇ ਆਪਣੇ ਪਿੰਡ ਨੂੰ ਛੱਡ ਕੇ ਸ਼ਹਿਰ ਵਿੱਚ ਵੱਸਣਾ ਪੈਂਦਾ ਹੈ ਇਸ ਲਈ ਹਰ ਕੋਈ ਜੀਵਨਸਾਥੀ ਲਈ ਸ਼ਹਿਰ ਵੱਲ ਜਾਂਦਾ ਹੈ